ਹੈਲੋ ਸਤਿ ਸ਼੍ਰੀ ਅਕਾਲ ਸਰ ਵਧੀਆ ਸਰ ਤੁਸੀਂ ਦੱਸੋ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਤੁਸੀਂ ਤੁਸੀਂ ਇਕੱਲੇ ਹੀ ਜਾਣਾ ਚਾਹੁੰਦੇ ਹੋ ਜਾਂ ਫੈਮਲੀ ਵਿਜ਼ਟ ਕਰਨਾ ਚਾਹੁੰਦੇ ਹੋ ਜੀ ਦੇਖੋ ਜੀ ਜੇ ਤਾਂ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਤਾਂ ਵੀ ਦੱਸ ਹਜ਼ਾਰ ਪਰ ਪਰਸਨ ਹੈਗਾ ਜੀ ਅਸੀਂ ਜਿਹੜਾ ਲੈਂਦੇ ਹਾਂ ਵਿੱਚੇ ਤੁਹਾਡਾ ਸੱਤ ਦਿਨ ਦਾ ਇਹ ਸਾਡਾ ਟੂਰ ਹੁੰਦਾ ਜੀ ਅਤੇ ਅਸੀਂ ਉੱਥੇ ਆਪਣੇ ਜਿੰਨੇ ਵੀ ਗੁਰਦੁਆਰਾ ਸਾਹਿਬ ਵਿਜ਼ਟ ਕਰਕੇ ਉਹਦੇ ਬਾਅਦ ਕੋਈ ਵੀ ਸਾਡੀ ਇੰਡਸਟਰੀ ਵਗੈਰਾ ਜਿਹੜੇ ਸਾਡੇ ਘੁੰਮਣ ਵਾਲੇ ਪਾਰਕ ਐਰਾ ਵਗੈਰਾ ਜਿਹੜੇ ਹੁੰਦੇ ਹੈ ਅਤੇ ਜੇ ਤੁਸੀਂ ਫੈਮਲੀ ਨਾਲ ਲੈਣਾ ਚਾਹੁੰਦੇ ਹੋ ਤਾਂ ਅਸੀਂ ਜਿਹੜੇ ਪੰਜ ਸਾਲ ਦੇ ਬੱਚੇ ਜਿਹੜੇ ਹੁੰਦੇ ਘੱਟ ਉਮਰ ਦੇ ਉਹਨਾਂ ਦਾ ਅਸੀਂ ਕੋਈ ਕਿਰਾਇਆ ਨਹੀਂ ਲੈਂਦੇ ਕੁਛ ਨੀ ਲੈਂਦੇ ਉਹਨਾਂ ਦਾ ਸਭ ਕੁਛ ਫ੍ਰੀ ਹੁੰਦੀ ਸਾਡੀ ਕੰਪਨੀ ਵੱਲ ਤੋਂ ਜੀ ਅਤੇ ਉੱਦੋਂ ਬੱਚਿਆਂ ਵਾਸਤੇ ਵੀ ਬੱਚੇ ਵੀ ਨਾਲ ਜਾਂਦੇ ਤਾਂ ਅਸੀਂ ਸਪੈਂਸਲ ਉਹਨਾਂ ਦਾ ਜਿਹੜਾ ਪੈਕਜ ਆਉਹ ਪੰਜ ਦਿਨਾਂ ਦਾ ਹੈ ਅਤੇ ਜੇ ਤੁਸੀਂ ਇਕੱਲੇ ਜਾਣਾ ਚਾਹੁੰਦੇ ਹੋ ਤਾਂ ਉਹ ਸੱਤ ਦਿਨਾਂ ਦਾ ਹੈ ਜੀ ਹਾਂਜੀ ਤੁਸੀਂ ਜੀ ਇੱਕ ਵਾਰ ਸਾਡੀ ਕੰਪਨੀ ਨੂੰ ਪੇ ਕਰਨਾ ਸਾਡੀ ਕੰਪਨੀ ਨੇ ਜੀ ਜਦੋਂ ਪੈਕੇਜ ਕੋਂਬੋ ਹੁੰਦੇ ਹੈ ਇਹ ਸਾਡੇ ਮਤਲਬ ਇੱਕ ਫੈਮਿਲੀ ਟੂਰ ਹੈ ਜਿਹੜੇ ਅਲੱਗ ਜਾਂਦੇ ਹੁੰਦੇ ਜਿਹੜੇ ਸਿੰਗਲ ਜਾਣਾ ਚਾਹੁੰਦੇ ਉਹ ਅਲੱਗ ਟੂਰ ਜਾਂਦੇ ਹੁੰਦੇ ਅਤੇ ਇਹਦੇ ਨਾਲ ਚੱਕਰ ਇਹ ਇਹਨਾਂ ਨਾਲ ਇਹ ਹੈ ਜੀ ਵੀ ਜਿਹੜਾ ਘੱਟ ਬਡਨ ਪੈਂਦਾ ਹੈ ਅਤੇ ਇਕੱਠੇ ਦੇ ਨਾਲ ਇਹ ਤੁਹਾਨੂੰ ਵੀ ਪਤਾ ਵੇ ਤੁਹਾਨੂੰ ਆਲੇ ਦੁਆਲੇ ਜਿਹੜੇ ਹੋਰ ਵੀ ਉੱਥੇ ਹੋਣੇ ਤੁਹਾਨੂੰ ਅਲੱਗ ਅਲੱਗ ਕਲਚਰ ਬਾਰੇ ਤੁਹਾਨੂੰ ਪਤਾ ਲੱਗਣਾ ਪ੍ਰੋਪਰ ਸਾਡੇ ਟੂਰਿਸਟ ਟੂਰਿਸਟ ਗਾਈਡ ਆ ਜਿਹੜੇ ਸਾਨੂੰ ਉੱਥੇ ਦੇ ਗਾਈਡ ਕਰੂਗੇਂ ਉਹਨਾਂ ਦੇ ਪੂਰੇ ਇਤਿਹਾਸ ਬਾਰੇ ਜਾਣੂ ਕਰਾਉਂਗੇ ਜੀ

ਤੁਸੀਂ ਤੁਸੀਂ ਏ ਇੱਦਾਂ ਨਾ ਬੁਕਿੰਗ ਕਰਵਾ ਸਕਦੇ ਹੋ ਜੀ ਇੱਦਾਂ ਜੋ ਸਾਡਾ ਜੀ ਇਹ ਨੈਕਸਟ ਵੀਕਐਂਡ ਜਿੱਦਾਂ ਜਿੱਦਾਂ ਤੁਹਾਡਾ ਪਲੈਨ ਹੋਇਆ ਜਿਹਦੇ ਮਾ ਜਿਸ ਤਰੀਕ ਤੁਸੀਂ ਜਾਣਾ ਤੁਸੀਂ ਸਾਨੂੰ ਇਹ ਪਹਿਲਾਂ ਦੱਸ ਦੇਣਾ ਅਤੇ ਤੁਸੀਂ ਕੁਛ ਕੁ ਪੈਸੇ ਦੋ ਕ ਹਜ਼ਾਰ ਰੁਪਏ ਤੱਕ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਕਿੰਨੇ ਮੈਂਬਰ ਜਾਣੇ ਹੈ ਅਤੇ ਉਹ ਐ ਜੇ ਤੁਸੀਂ ਬਾਅਦ 'ਚ ਤੁਹਾਡਾ ਕੈਂਸਲ ਵੀ ਹੋ ਜਾਂਦਾ ਤੁਹਾਡੀ ਅਸੀਂ ਇਹਦੀ ਪੰਦ ਉਹਦੇ ਚੋਂ ਪੰਜ ਸੌ ਰੁਪਇਆ ਕੱਟ ਕੇ ਪੰਦਰਾਂ ਸੌ ਜਿਹੜੀ ਫੀਸ ਤੁਹਾਡੀ ਇਹ ਰਿਫੰਡ ਵੀ ਕਰ ਸਕਦੇ ਹੈ ਜੀ ਹਾਂ ਅਗਰ ਮੰਨ ਲਾਂ ਤੁਹਾਡਾ ਕੋਈ ਕੈਂਸਲ ਪ੍ਰੋਗਰਾਮ ਹੁੰਦਾ ਕਿਸੇ ਕਾਰਨ ਹੁੰਦਾ ਜੇ ਮਤਲਬ ਉਹ ਹੈ ਤਾਂ ਤੁਹਾਡੀ ਜਿਹੜੀ ਹੈ ਫੀਸ ਰਿਫੰਡ ਕੀਤੀ ਜਾਊਗੀ ਸਿਰਫ਼ ਪੰਜ ਸੌ ਰੁਪਇਆ ਉਹਦੇ 'ਚੋਂ ਕੱਟਿਆ ਜਾਊਗਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅਤੇ ਜਿਹੜੇ ਜਿਹੜੇ ਮੇਨ ਮੇਨ ਜਿਹੜੇ ਹੈਗੇ ਹੈ ਜੀ ਉਹ ਸਾਰੇ ਤੁਹਾਨੂੰ ਦੱਸੇ ਜਾਣਗੇ ਉਹਨਾਂ ਬਾਰੇ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾਊਂਗੀ ਅਤੇ ਅਗਰ ਬੱਚੇ ਵੀ ਜਾਣਾ ਚਾਹੁੰਦੇ ਆ ਤਾਂ ਬੱਚੇ ਵਾਸਤੇ ਵੀ ਅਲੱਗ ਉਹ ਹੈ ਜੀ ਹਾਂਜੀ ਹਾਂਜੀ ਬੱਚਿਆ ਦੇ ਪੰਜ ਸਾਲ ਦੇ ਤਰਫ ਤੋਂ ਕੋਈ ਉਹ ਨਹੀਂ ਆ ਜੀ ਪੰਜ ਸਾਲ ਦੇ ਉੱਪਰ ਕੋਈ ਬੱਚਾ ਹੈਗਾ ਤਾਂ ਉਹਨਾਂ ਦਾ ਜੀ ਅਸੀਂ ਚਾਰ ਹਜ਼ਾਰ ਰੁਪਇਆ ਚਾਰਜ ਕਰਦੇ ਹਾਂ ਜੀ ਹਾਂਜੀ ਜੇ ਤੁਸੀਂ ਜ਼ਿਆਦਾ ਫੈਮਿਲੀ ਜਿੱਦਾਂ ਹੈਗਾ ਜਿੱਦਾਂ ਹੁਣ ਤੁਸੀਂ ਆਪਣੇ ਆਪਣੇ ਸੱਤ ਛੇ ਜਾਂ ਸੱਤ ਜਣੇ ਆ ਗਏ ਤਾਂ ਤੁਸੀਂ ਇੱਕ ਇੱਕ ਜਾਣਾ ਤੁਸੀਂ ਕੋਈ ਵੀ ਫ੍ਰੀ ਲੈ ਕੇ ਜਾ ਸਕਦੇ ਹੋ ਸਾਡੇ ਜਿਹੜੀ ਕੰਪਨੀ ਵੱਲ ਤੋਂ ਓਫਰ ਹੈ ਜੀ ਹਾਂਜੀ ਨਹੀਂ ਨਹੀਂ ਜੀ ਸੌ ਨੌ ਜਿੱਦਾਂ ਕੋਈ ਇੱਥੇ ਪਾਇਕ ਮਸ਼ਹੂਰ ਮਿਊਜ਼ੀਅਮ ਮਿਊਜ਼ੀਅਮ ਵੀ ਹੈਗਾ ਤੁਹਾਨੂੰ ਮਿਊਜ਼ੀਅਮ ਵੀ ਲੈ ਕੇ ਜਾਵਾਂਗੇ ਤੁਹਾਨੂੰ ਇੱਕ ਪਾਰਕ ਹੈਗਾ ਮਸ਼ਹੂਰ ਸਾਡੇ ਉੱਥੇ ਉਹ ਤੁਹਾਨੂੰ ਉਹ ਵੀ ਦਿਖਾਵਾਂਗੇ ਅਤੇ ਉਸ ਤੋਂ ਬਾਅਦ ਫਿਰ ਜਿਹੜੇ ਇੱਕ ਵੋਟਰ ਵੋਟਰ ਪਾਰਕ ਵੀ ਸਾਡਾ ਇੱਕ ਪਲੈਨਿੰਗ ਚੱਲ ਰਿਹਾ ਅਸੀਂ ਸੋਚ ਰਹੇ ਕਿ ਇਹਦੇ ਨਾਲ ਹੀ ਜਿਹੜਾ ਇੱਕ ਉੱਥੇ ਸਾਨੂੰ ਲੱਗਿਆ ਕਿ ਉੱਥੇ ਇੱਕ ਵਧੀਆ ਵੋਟਰ ਪਾਰਕ ਹੈ ਤਾਂ ਅਸੀਂ ਸੋਚਦੇ ਕਿ ਫੈਮਲੀ ਨੂੰ ਉੱਥੇ ਵਿਜ਼ਟ ਕਰਵਾਈਏ ਨਿਆਣਿਆਂ ਨੂੰ ਉੱਥੇ ਕਰਵਾਈਏ ਜੀ ਹਾਂਜੀ ਇਹ ਕੋਈ ਵੀ ਜਿੱਦਾਂ ਵੀ ਹੋਏ ਦੱਸ ਦਿਓ ਮੈਨੂੰ ਜੀ ਓਕੇ ਜੀ ਓਕੇ